ਚੋਦਾਂ ਸਾਲ ਦੀ ਉਮਰ ਤੋਂ ਘੱਟ ਉਮਰ ਦੇ ਬੱਚਿਆਂ ਰਾਹੀਂ ਕੰਮ ਕਰਨ ਨੂੰ ਬਾਲ ਮਜ਼ਦੂਰੀ ਕਿਹਾ ਜਾਂਦਾ ਹੈ ਜਾਂ ਆਮ ਸ਼ਬਦਾਂ ਵਿੱਚ ਅਸੀਂ ਕਹੀਏ ਤਾਂ ਕਿਸੇ ਵੀ ਖੇਤਰ ਵਿੱਚ ਬੱਚਿਆਂ ਦਾ ਰਾਹ ਬਚਪਨ ਵਿੱਚ ਦਿੱਤੀ ਗਈ ਸੇਵਾ ਨੂੰ ਬਾਲ ਮਜ਼ਦੂਰੀ ਆਪਾਂ ਕਹਿ ਸਕਦੇ ਹਾਂ ਇਹ ਬੱਚਿਆਂ ਤੋਂ ਦਬਾਓ ਪੂਰਵਕ ਮਾਤਾ ਪਿਤਾ ਜਾਂ ਫੈਕਟਰੀਆਂ ਦੇ ਮਾਲਕਾਂ ਦੁਆਰਾ ਕਰਵਾਈ ਜਾਂਦੀ ਹੈ ਬਾਲ ਮਜ਼ਦੂਰੀ ਕਾਰਣ ਹੀ ਬੱਚਾ ਆਪਣਾ ਬਚਪਨ ਜਿਉਣਾ ਭੁੱਲ ਜਾਂਦਾ ਹੈ ਇਸੇ ਕਾਰਣ ਬੱਚੇ ਨਿਯਮਤ ਤੌਰ 'ਤੇ ਸਕੂਲ ਜਾਣ ਤੋਂ ਅਸਮਰੱਥ ਹੋ ਜਾਂਦੇ ਹਨ ਬਾਲ ਮਜ਼ਦੂਰੀ ਇੱਕ ਵਿਸ਼ਵ ਸਮੱਸਿਆ ਬਣ ਚੁੱਕੀ ਹੈ ਜੋ ਵਿਕਾਸਸ਼ੀਲ ਦੇਸ਼ਾਂ ਵਿੱਚ ਆਮ ਹੈ ਸਾਡੇ ਦੇਸ਼ ਵਿੱਚ ਇਹ ਸਮਾਜਿਕ ਸਮੱਸਿਆ ਬਣਦੀ ਜਾ ਰਹੀ ਹੈ ਬਾਲ ਮਜ਼ਦੂਰੀ ਇਨਸਾਨੀਅਤ ਲਈ ਇੱਕ ਗੁਨਾਹ ਹੈ ਸਾਡੇ ਇਲਾਕੇ ਵਿੱਚ ਵੀ ਬਾਲ ਮਜ਼ਦੂਰੀ ਕਰਨ ਵਾਲੇ ਬੱਚੇ ਦੇਖੇ ਜਾ ਸਕਦੇ ਹਨ ਅੱਜ ਕੱਲ੍ਹ ਬੱਚੇ ਦੁਕਾਨਾਂ ਹੋਟਲਾਂ ਢਾਬਿਆਂ 'ਤੇ ਛੋਟੇ ਛੋਟੇ ਕੰਮ ਕਰਦੇ ਹਨ ਜਿਵੇਂ ਸਾਫ਼ ਸਫ਼ਾਈ ਭਾਂਡੇ ਮਾਂਜਣ ਦਾ ਕੰਮ ਖਾਣਾ ਬਣਾਉਣ ਦਾ ਕੰਮ ਆਦਿ ਇਸ ਤਰ੍ਹਾਂ ਘਰਾਂ ਵਿੱਚ ਵੀ ਬੱਚਿਆਂ ਨੂੰ ਖ਼ਾਸ ਕਰਕੇ ਕੁੜੀਆਂ ਨੂੰ ਘਰਾਂ ਦੇ ਕੰਮ ਕਰਨ ਵਾਸਤੇ ਰੱਖਿਆ ਜਾਂਦਾ ਹੈ ਜਿਸ ਵਿੱਚ ਛੋਟੇ ਬੱਚਿਆਂ ਨੂੰ ਸੰਭਾਲਣ ਸਾਫ਼ ਸਫ਼ਾਈ ਕਰਨ ਕੱਪੜੇ ਧੋਣ ਆਦਿ ਵਰਗੇ ਕੰਮ ਕਰਵਾਏ ਜਾਂਦੇ ਹਨ ਇਹ ਬੱਚੇ ਘਰਾਂ ਦੀ ਮਜ਼ਬੂਰੀ ਜਾਂ ਹਾਲਾਤਾਂ ਕਾਰਣ ਅਜਿਹੇ ਕੰਮ ਕਰਨ ਲਈ ਮਜ਼ਬੂਰ ਹੁੰਦੇ ਹਨ ਇੰਨਾ ਹੀ ਨਹੀਂ ਬੱਚਿਆਂ ਦੀ ਛੋਟੀ ਉਮਰ ਹੋਣ ਕਰਕੇ ਉਹਨਾਂ ਦਾ ਸੋਸ਼ਣ ਵੀ ਕੀਤਾ ਜਾਂਦਾ ਹੈ ਜਿਵੇਂ ਉਹਨਾਂ ਨੂੰ ਮਜ਼ਦੂਰੀ ਵਜੋਂ ਘੱਟ ਪੈਸੇ ਦੇਣੇ ਉਹਨਾਂ ਨਾਲ ਸਖ਼ਤੀ ਵਾਲਾ ਵਿਵਹਾਰ ਕਰਨਾ ਆਦਿ ਜਿਸ ਕਾਰਨ ਉਹਨਾਂ ਦੀ ਉਹਨਾਂ ਦਾ ਆਪਣਾ ਮਨ ਮਾਰ ਕੇ ਕੰਮ ਕਰਨਾ ਪੈਂਦਾ ਹੈ ਕਿਉਂਕਿ ਉਹਨਾਂ ਨੇ ਇਸ ਮਜ਼ਦੂਰੀ ਰਾਹੀਂ ਆਪਣੇ ਘਰਾਂ ਦਾ ਗੁਜ਼ਾਰਾ ਚਲਾਉਣਾ ਹੁੰਦਾ ਹੈ ਬਾਲ ਮਜ਼ਦੂਰੀ ਅਤੇ ਸ਼ੋਸ਼ਣ ਦੀ ਨਿਰੰਤਰ ਮੌਜੂਦਗੀ ਦੇਸ਼ ਦੀ ਅਰਥ ਵਿਵਸਥਾ ਲਈ ਖਤਰਾ ਹੈ ਅਤੇ ਇਸ ਦੇ ਖਤਰਨਾਕ ਸਿੱਟੇ ਵੀ ਨਿਕਲਦੇ ਹਨ ਜਿਵੇਂ ਬੱਚਿਆਂ ਦਾ ਸਿੱਖਿਆ ਤੋਂ ਵਾਂਝਾ ਹੋਣਾ ਉਹਨਾਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਰੁਕਾਵਟ ਬੱਚਿਆਂ ਦੀ ਤਸਕਰੀ ਵੀ ਬਾਲ ਮਜ਼ਦੂਰੀ ਦਾ ਹੀ ਨਤੀਜਾ ਹੈ ਇਸ ਲਈ ਦੇਸ਼ ਦੀ ਆਰਥਿਕ ਉੱਨਤੀ ਲਈ ਹਰੇਕ ਖੇਤਰ ਵਿੱਚ ਬਾਲ ਮਜ਼ਦੂਰੀ 'ਤੇ ਲੋਭ ਰੋਕ ਲਗਾਉਣੀ ਚਾਹੀਦੀ ਹੈ ਇਸ ਲਈ ਸਰਕਾਰ ਨੂੰ ਸਖ਼ਤੀ ਨਾਲ ਬਾਲ ਮਜ਼ਦੂਰੀ ਦੇ ਕਾਨੂੰਨਾਂ ਦਾ ਉਲੰਘਣ ਕਰਨ ਵਾਲੇ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੀ ਗੰਭੀਰ ਸਮੱਸਿਆ ਤੋਂ ਬੱਚਿਆਂ ਨੂੰ ਨਿਜਾਤ ਮਿਲ ਸਕੇ